ਮੈਂ ਕਦੀ ਜ਼ਿੰਦਗੀ ਦੇ ਵਿੱਚ ਕਦੀ ਬੋਰਡ ਤਿਆਰ ਨਹੀਂ ਕੀਤਾ ਹੈਗਾ ਪਰ ਇਹ ਮੇਰਾ ਜਿਹੜਾ ਸਵਾਲ ਹੈ ਮੇਰੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ਕੋਈ ਸਵਾਲ ਆਇਆ ਕਿ ਕੀ ਤੁਸੀਂ ਕਦੀ ਆਪ ਆਪਣਾ ਬੋਰਡ ਤਿਆਰ ਕੀਤਾ ਨਹੀਂ ਮੈਂ ਕਦੀ ਕੋਈ ਬੋਰਡ ਤਿਆਰ ਨਹੀਂ ਕੀਤਾ ਹੈਗਾ ਲੱਕੜ ਦੀ ਪਹਿਚਾਨ ਮੈਨੂੰ ਇੰਨੀ ਨਹੀਂ ਹੈਗੀ ਫਿਰ ਮੈਂ ਝੂਠ ਬੋਲਾਂ ਲੱਕੜ ਦੀ ਪਹਿਚਾਨ ਮੈਨੂੰ ਹੈ ਨਹੀਂ ਗੀ ਪਰ ਜੇ ਮੈਂ ਕਦੀ ਬੋਰਡ ਤਿਆਰ ਕੀਤਾ ਵੀ ਤਾਂ ਮਤਲਬ ਮੈਂ ਜਿਹੜਾ ਬੋਰਡ ਆ ਉਹ ਚੌਰਸ ਰੱਖ ਕੇ ਉਹਦੇ ਉੱਪਰ ਇੱਕ ਕਲਿੱਪ ਜਿਹਾ ਲਗਾਊਂਗੀ ਅਤੇ ਪੇਂਟ ਪੇਂਟ ਨਹੀਂ ਕਰੂੰਗੀ ਛੋਟੀ ਛੋਟੀ ਪੇਂਟਿੰਗ ਕਰੂੰਗੀ ਉਹਦੇ 'ਤੇ ਪਹਿਲਾਂ ਮੈਂ ਉਹ ਜਿਹੜਾ ਬੋਰਡ ਆ ਉਹ ਨੂੰ ਹਲਕੇ ਜੇ ਹਲਕੇ ਜਿਹੇ ਗੋਲਡਨ ਸ਼ੇਡ ਦਾ ਜਾਂ ਲਾਈਟ ਬੇਬੀ ਪਿੰਕ ਸ਼ੇਡ ਦਾ ਕਰੂੰਗੀ ਉਹ ਤੋਂ ਬਾਅਦ ਉਹਦੇ ਉੱਤੇ ਮੀਨਾਕਾਰੀ ਕਰੂੰਗੀ ਫੁੱਲ ਬੂਟੇ ਬਣਾਉਂਗੀ ਛੋਟੇ ਛੋਟੇ ਸੋਹਣੇ ਸਜਾਵਟ ਕਰੂੰਗੀ ਉਹ ਵੀ ਹੱਥਾਂ ਨਾਲ ਪੇਂਟ ਕਰੂੰਗੀ ਕੋਈ ਬਜ਼ਾਰੀ ਕੋਈ ਸਟਿੱਕਰ ਨਹੀਂ ਲਗਵਾਉਂਦੀ ਕੋਈ ਬਿੰਦੀ ਬੂਟੀ ਨਹੀਂ ਲਗਾਉਂਦੀ ਹੈਗੀ ਮੈਂ ਉਹਦੇ ਉੱਪਰ ਪਰ ਮੈਂ ਜਿੰਨਾ ਵੀ ਤਿਆਰ ਕੀਤਾ ਉਹ ਲੱਕੜ ਦਾ ਮੈਨੂੰ ਇੰਨਾ ਕੋਈ ਹਅ ਅਨੁਭਵ ਨਹੀਂ ਹੈਗਾ ਪਰ ਕੋਈ ਗੱਲ ਨਹੀਂ ਜਿੰਨਾ ਮੈਨੂੰ ਜਿੰਨੀ ਕੁ ਸਮਝ ਹੋਈ ਮੈਂ ਮਜ਼ਬੂਤ ਲੱਕੜ ਲੈ ਕੇ ਉਹਨੂੰ ਚੌਰਸ ਲੈਗ ਬਣਵਾ ਕੇ ਉਹਨੂੰ ਉਹਦੀ ਪਹਿਲਾਂ ਕ ਸ ਲੱਕੜ ਪਸੰਦ ਕਰੂੰਗੀ ਫਿਰ ਉਹਦੀ ਚੌਰਸ 'ਚ ਕਟਾਈ ਕਰੂੰਗੀ ਕਟਾਈ ਕਰਕੇ ਫਿਰ ਉਹਨੂੰ ਕੀ ਆ ਕਿ ਸਾਰੇ ਪਾਸਿਓਂ ਮਾੜਾ ਮਾੜਾ ਰੇਗਮਲ ਨਾਲ ਉਹਨੂੰ ਠੀਕ ਕਰ ਦੂੰਗੀ ਤਾਂ ਕਿ ਉਹ ਜਿਹੜੀਆਂ ਉਹਦੀਆਂ ਨੁਕਰਾਂ ਨੇ ਉਹ ਚੁੱਬਨ ਨਾ ਉਹਨੂੰ ਲੱਗਣ ਨਾ ਕੋਈ ਜ਼ਖਮ ਨਾ ਹੋਵੇ ਕੋਈ ਕੁਛ ਨਾ ਹੋਵੇ ਉਹ ਤੋਂ ਬਾਅਦ ਉਹਨੂੰ ਕੀ ਆ ਕਿ ਹਲਕਾ ਜਿਹਾ ਪੇਂਟ ਕਰੂੰਗੀ ਪੇਂਟ ਮੈਂ ਮੇਰੇ ਦਿਮਾਗ ਦੇ ਵਿੱਚ ਥੋੜ੍ਹਾ ਜਿਹਾ ਗੋਲਡਨ ਜਾਂ ਗੋਲਡਨ ਜਾਂ ਗਰੇ ਕਲਰ ਦੇ ਵਿੱਚ ਜਾਂ ਬੇਬੀ ਪਿੰਕ ਸ਼ੇਡ ਇਹੋ ਜਿਹਾ ਲਗਾਉਂਗੀ ਉਸਦੇ ਉੱਪਰ ਬਾਅਦ ਦੇ ਵਿੱਚ ਮੈਂ ਮੀਨਾਕਾਰੀ ਕਰੂੰਗੀ ਛੋਟੇ ਛੋਟੀਆਂ ਪੱਤੀਆਂ ਹੋ ਗਈਆਂ ਫੁੱਲ ਹੋ ਗਏ ਐਵੇਂ ਐਵੇਂ ਦੀਆਂ ਚੀਜ਼ਾਂ ਕ ਲਾ ਕਰੂੰਗੀ ਮੈਂ ਅਤੇ ਉਹਦੇ ਉੱਪਰ ਵੇਲਾਂ ਬਣਾਉਂਗੀ ਵੇਲ ਬਣਾ ਕੇ ਫਿਰ ਉਹਦੇ ਵਿੱਚ ਬਿੰਦੀਆਂ ਲਗਾ ਦਿੱਤੀਆਂ ਪੱਤੀਆਂ ਬਣਾ ਦਿੱਤੀਆਂ ਛੋਟੇ ਛੋਟੇ ਫੁੱਲ ਬਣਾ ਅਤੇ ਆਸੇ ਪਾਸੇ ਵਿੱਚ ਅਤੇ ਵਿੱਚ ਕੁਛ ਨਹੀਂ ਬਸ ਮੈਂ ਆਸੇ ਪਾਸੇ ਉਹਦੀ ਜਿਹੜੀ ਮੀਨਾਕਾਰੀ ਕਰੂੰਗੀ ਉਹਨੂੰ ਪੇਂਟ ਕਰੂੰਗੀ ਉਹਦੇ 'ਚ ਫਿਰ ਬੂਟੀਆਂ ਬਣਾਉਂਗੀ ਉੱਤੇ ਇੱਕ ਕਲਿੱਪ ਲਾਉਂਗੀ ਤਾਂ ਕਿ ਬੋਰਡ ਅਲਟਾ ਮੇਰਾ ਕਿਸੇ ਕੰਮ ਆ ਸਕੇ ਮੈਂ ਉਹਨੂੰ ਪੇਪਰਾਂ ਦੇ ਵਿੱਚ ਬੱਚਿਆਂ ਦੇ ਲਈ ਕੰਮ ਉਹਦਾ ਉਹਨਾਂ ਦੇ ਕੰਮ ਆ ਜਾਵੇ ਅਤੇ ਐਕਸੀਬਿਸ਼ਨ ਨੂੰ ਵੀ ਉਹਨਾਂ ਦੀ ਸਕੂਲ ਦੇ ਵਿੱਚ ਕਈ ਵਾਰ ਐਕਸੀਬਿਸ਼ਨ ਲੱਗਦੇ ਹੁੰਦੇ ਉਹਦੇ ਵਿੱਚ ਵੀ ਕੰਮ ਆ ਸਕਦੇ ਆ ਬਾਕੀ ਮੀਨਾਕਾਰੀ ਕਰੂੰਗੀ ਉਹਨਾਂ 'ਤੇ ਪੇਂਟ ਕਰੂੰਗੀ ਰੰਗ ਬਿਰੰਗੇ ਸਾਰੇ ਕਲਰ ਦੇ ਰੰਗ ਲਗਾਉਂਗੀ ਹਰਾ ਲਾਲ ਪੀਲਾ ਗੁਲਾਬੀ ਜਾਮਨੀ ਖੱਟਾ ਅਤੇ ਮਹਰੂਨ ਹੋ ਗਿਆ ਮਜੈਂਟਾ ਹੋ ਗਿਆ ਹਰ ਇੱਕ ਕੰਮ ਨੂੰ ਬਰੀਕੀ ਨਾਲ ਕਰੂੰਗੀ ਤਾਂ ਕਿ ਜਿਹੜਾ ਮੇਰਾ ਬੋਰਡ ਆ ਉਹ ਦੇਖਣ 'ਚ ਵੀ ਸੋਹਣਾ ਲੱਗੇ ਉਸਤੇ ਮੱਲੋ ਮਲੀ ਕੰਮ ਕਰਨ ਨੂੰ ਜੀ ਕਰੇ ਪਿਆਰਾ ਲੱਗੇ ਪਿਆ ਵੀ ਸੋਹਣਾ ਲੱਗੇ ਕੰਮ ਕਰਨ ਨੂੰ ਵੀ ਉਹਦੇ ਨਾਲ ਸਾਡਾ ਜੀ ਕਰੇ